ਜਿਵੇਂ ਕਿ ਸਿੱਖਿਆ ਦੇ ਪੱਧਰ ਦੀ ਗੱਲ ਕਰੀਏ ਤਾਂ ਹਰ ਇਲਾਕੇ ਵਿੱਚ ਹਰ ਸਕੂਲ ਆਪਣੀ ਅਲੱਗ ਹੀ ਵਿਸ਼ੇਸ਼ਤਾ ਰੱਖਦਾ ਹੈ ਸਾਡੇ ਇਲਾਕੇ ਵਿੱਚ ਬਹੁਤ ਸਾਰੇ ਇੱਦਾਂ ਦੇ ਸਕੂਲ ਹਨ ਜੋ ਕਿ ਆਪਣੀਆਂ ਅਲੱਗ ਅਲੱਗ ਵਿਸ਼ੇਸ਼ਤਾ ਰੱਖਦੇ ਹਨ ਜੇਕਰ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਸਕੂਲਾਂ ਵਿੱਚੋਂ ਸਰਕਾਰੀ ਸਕੂਲ ਹੈ ਮੇਰੇ ਪਿੰਡ 'ਚ ਜੋ ਮੌਜੂਦ ਨੇ ਪ੍ਰਾਈਵੇਟ ਸਕੂਲ ਨੇ ਅਲੱਗ ਅਲੱਗ ਸਭ ਦੀ ਆਪਣੀ ਮਹਾਨਤਾ ਹੈ ਇਹਨਾਂ ਸਕੂਲਾਂ ਵਿੱਚੋਂ ਸਭ ਦੀ ਵਿਸ਼ੇਸ਼ਤਾ ਮੈਂ ਦੇਣਾ ਚਾਹੂੰਗੀ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਨੂੰ ਰਿਆਤ ਇੰਟਰਨੈਸ਼ਨਲ ਸਕੂਲ ਆਪਣੀ ਜਗ੍ਹਾ 'ਤੇ ਆਪਣੀਆਂ ਅਲੱਗ ਹੀ ਵਿਸ਼ੇਸ਼ਤਾ ਰੱਖਦਾ ਹੈ ਕਿਉਂਕਿ ਇਸ ਸਕੂਲ ਵਿੱਚ ਹਰ ਫੈਸਿਲਿਟੀ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਜੋ ਕਿ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਹਰ ਬੱਚੇ ਲਈ ਹਰ ਬੱਚੇ ਦੇ ਸਿੱਖਣ ਲਈ ਉਹਨਾਂ ਦੇ ਉਹਨਾਂ ਉਹਨਾਂ ਨੂੰ ਪੋਜ਼ੀਟਿਵ ਬਣਾਉਣ ਲਈ ਰਿਆਤ ਬਾਹਰਾ ਸਕੂਲ ਦੇ ਨਾਲ਼ ਨਾਲ਼ ਰਿਆਤ ਬਾਹਰਾ ਕੋਲਿਜ ਵੀ ਹੈ ਜੋ ਕਿ ਬਹੁਤ ਹੀ ਫੇਮਸ ਹੈ ਇਹ ਅ ਰੋਪੜ ਦੇ ਨੀਅਰ ਨੇੜੇ ਪੈਂਦਾ ਹੈ ਇਹ ਇਹ ਸਕੂਲ ਇਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਪੜ੍ਹਦੇ ਨੇ ਦੂਰੋਂ ਨੇੜਿਓਂ ਹਰ ਕੋਈ ਆਪਣੀ ਸਿੱਖਿਆ ਇੱਥੋਂ ਉਪਲਬਧ ਕਰਦਾ ਸਕੂਲ ਦੀ ਵਿਸ਼ੇਸ਼ਤਾ ਬਾਰੇ ਗੱਲ ਕਰੀਏ ਤਾਂ ਉੱਥੇ ਸਟਾਫ਼ ਬਹੁਤ ਹੀ ਜ਼ਿਆਦਾ ਮਿਹਨਤੀ ਹੈ ਜੋ ਕਿ ਬੱਚੇ ਨੂੰ ਹਰ ਚੀਜ਼ ਸਿਖਾਉਂਦਾ ਭਾਵੇਂ ਉਹ ਪ੍ਰੈਕਟੀਕਲੀ ਹੈ ਭਾਵੇਂ ਉਹ ਥਿਊਰੀ ਹੈ ਹਰੇਕ ਚੀਜ਼ ਵਧੀਆ ਢੰਗ ਨਾਲ਼ ਸਿੱਖਣ ਨੂੰ ਮਿਲਦੀ ਹੈ ਬੱਚਿਆਂ ਨੂੰ ਜੇਕਰ ਉੱਥੇ ਇਸ ਜ ਅ ਗੱਲ ਕਰੀਏ ਫੈਸਿਲਟੀਜ਼ ਦੀ ਹਰੇਕ ਤਰ੍ਹਾਂ ਦੀ ਫੈਸਿਲਿਟੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਪੀਣ ਦਾ ਪਾਣੀ ਤੱਕ ਐਨ ਵਧੀਆ ਬਿਲਕੁਲ ਸਾਰਾ ਸਭ ਕੁਛ ਪ੍ਰੋਵਾਈਡ ਕੀਤਾ ਜਾਂਦਾ ਹੈ ਅਤੇ ਉੱਥੇ ਇਸ ਸਕੂਲ ਵਿੱਚ ਦੋ ਪਲੇਅਗਰਾਊਂਡ ਨੇ ਇੱਕ ਸਵੀਵਿੰਗ ਪੂਲ ਵਗੈਰਾ ਵੀ ਹੈਗਾ ਸਭ ਕੁਛ ਸਭ ਤੋਂ ਮੇਨ ਗੱਲ ਇਹਨਾਂ ਦੀ ਕਿ ਇਹ ਹਰ ਵਾਰ ਬੱਚਿਆਂ ਨੂੰ ਇੱਕ ਹਿਸਟੋਰੀਕਲ ਪਲੇਸ 'ਤੇ ਲੈ ਕੇ ਜਾਂਦੇ ਨੇ ਕਿ ਜਿਹਦੇ ਕਰਕੇ ਬੱਚਿਆਂ ਦੇ ਦਿਮਾਗ਼ 'ਚ ਬਹੁਤ ਹੀ ਜ਼ਿਆਦਾ ਪੋਜ਼ੀਟਿਵਿਟੀ ਆਉਂਦੀ ਹੈ ਹੈ ਨਾ ਅਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਇਸ ਸਕੂਲ ਵਿੱਚ ਸਾਡੇ ਘਰ ਦੇ ਖੁਦ ਦੋ ਬੱਚੇ ਜਾਂਦੇ ਨੇ ਜਿਨ੍ਹਾਂ ਦਾ ਰਿਜ਼ਲਟ ਦੇਖ ਕੇ ਮੈਂ ਬਹੁਤ ਜ਼ਿਆਦਾ ਮ ਮਤਲਬ ਖੁਸ਼ ਹੁੰਦੀ ਹਾਂ ਅਤੇ ਜੇਕਰ ਇਸ ਸੰਕੂ ਸਕੂਲ ਦੀ ਸੰਤੁਸ਼ਟਤਾ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਸਕੂਲ ਬਹੁਤ ਹੀ ਜ਼ਿਆਦਾ ਸੰਤੁਸ਼ਟਤਾ ਦਿੰਦਾ ਬਹੁਤ ਜ਼ਿਆਦਾ ਖੁਸ਼ੀ ਦਿੰਦਾ ਹੈ ਨਾ ਕਿ ਇਹਦਾ ਰਿਜਲਟ ਸਾਰੇ ਸਕੂਲਾਂ ਨਾਲੋਂ ਅਲੱਗ ਹੀ ਆਉਂਦਾ ਹੈ ਅਤੇ ਇਸ ਲਈ ਮੈਨੂੰ ਇਹ ਸਕੂਲ ਸਭ ਤੋਂ ਜ਼ਿਆਦਾ ਪਸੰਦ ਹੈ ਕਿਉਂਕਿ ਇੱਥੇ ਹਰ ਬੱਚੇ ਨੂੰ ਹਰ ਜਗ੍ਹਾ 'ਤੇ ਹਰ ਨਵੀਂ ਗੱਲ ਸਿੱਖਣ ਨੂੰ ਮਿਲਦੀ ਹੈ